ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਸੁਣਾਓ ਕਿੱਦਾਂ ਵਧੀਆ ਜੇ ਹਾਂ ਮੈਂ ਵੀ ਠੀਕ ਠਾਕ ਤੁਸੀਂ ਸੁਣਾਓ ਹੋਰ ਸਭ ਠੀਕ ਠਾਕ ਤੁਸੀਂ ਹੁੰਦੇ ਕਿੱਥੇ ਹੋ ਅੱਜ ਕੱਲ੍ਹ ਮੈਂ ਕੱਲ੍ਹ ਵੀ ਤੁਹਾਡੀ ਦੁਕਾਨ 'ਤੇ ਆਇਆ ਸੀ ਤੁਸੀਂ ਆਏ ਨਹੀਂ ਸੀ ਦੁਕਾਨ 'ਤੇ ਅੱਛਾ ਅੱਛਾ ਨਹੀਂ ਮੈਂ ਬਥੇਰੇ ਚੱਕਰ ਲਾ ਲਏ ਤਾਂ ਕੱਲ੍ਹ ਮੈਂ ਪਹਿਲਾਂ ਆਇਆ ਤੁਹਾਡੀ ਦੁਕਾਨ ਬੰਦ ਸੀ ਦੂਜੀ ਵਾਰ ਆਇਆ ਤਾਂ ਤੁਸੀਂ ਦੁਕਾਨ 'ਤੇ ਹੈ ਹੀ ਨਹੀਂ ਤੁਸੀਂ ਗਏ ਤੇ ਹੈ ਮੁੰਡਾ ਬੈਠਾ ਤਾਂ ਜੀ ਇੱਕ ਮੈਂ ਉਹਨੂੰ ਪੁੱਛਿਆ ਉਹ ਕਹਿੰਦਾ ਭਾਅ ਜੀ ਅੱਗੇ ਗਏ ਨੇ ਅੱਛਾ ਅੱਛਾ ਆਹੋ ਮੈਂ ਵੈਸੇ ਇਹ ਗੱਲ ਕਰਾ ਆਹੋ ਆਹੋ ਉਹ ਭਾਅ ਜੀ ਮੈਂ ਤੁਹਾਡੇ ਕੋਲ ਇੱਕ ਬੈਕ ਖਰੀਦਿਆ ਜਿਹੜਾ ਇਹਲਾ ਲੈਦਰ ਵਾਲਾ ਇਹਲਾ ਇਹਲਾ ਆਹੋ ਇਹ ਤਾਂ ਭਰਾਵਾ ਜਮਾਂ ਹੀ ਮਾੜਾ ਨਿਕਲਿਆ ਨਹੀਂ ਨਹੀਂ ਮੈਂ ਉਹ ਥੋੜ੍ਹਾ ਨਾ ਕਹਿ ਰਿਹਾ ਕਿ ਤੁਹਾਡੇ ਕੋਲ ਸਮਾਨ ਮਾੜਾ ਮੈਂ ਤਾਂ ਨਹੀਂ ਨਹੀਂ ਭਾਅ ਜੀ ਉਹ ਜਿਹੀ ਗੱਲ ਥੋੜ੍ਹਾ ਨਾ ਚੰਗਾ ਹੀ ਸਮਾਨ ਦਿੰਦੇ ਹੋ ਤੁਸੀਂ ਇਹੀ ਗੱਲ ਕਰਨੀ ਸੀ ਮੈਂ ਕਿ ਲੈਦਰ ਦਾ ਬੈਗ ਬੜਾ ਮਾੜਾ ਨਿਕਲਿਆ ਇਹਲਾ ਤੁਹਾਡੇ ਕੋਲ ਜਿਹੜੇ ਪਹਿਲਾਂ ਬੈਗ ਲੈ ਕੇ ਗਏ ਉਹ ਠੀਕ ਨਿਕਲੇ ਹਾਂਜੀ ਹਾਂਜੀ ਤੁਸੀਂ ਆਪ ਹੀ ਦੇਖ ਲਓ ਭਾਅ ਜੀ ਇਹਦਾ ਲੈਦਰ ਵੀ ਉੱਤਰਿਆ ਕਰਦੀ ਹੈ ਧਾਗੇ ਵੀ ਨਿਕਲੇ ਕਰਦੇ ਤਣੀਆਂ ਵੀ ਟੁੱਟੇ ਦੀਆਂ ਮੇ ਇਹ ਭਾਅ ਜੀ ਦੋ ਕੁ ਹਫ਼ਤਾ ਹੋਇਆ ਮੈਨੂੰ ਬੈਗ ਲੈ ਕੇ ਗਏ ਦਿਆ ਨੂੰ ਫਿਰ ਇੰਨੀ ਇੰਨੀ ਜਲਦੀ ਚੱਲ ਕੱਢਣਾ ਤਾਂ ਮਹੀਨਾ ਹੀ ਕੱਢ ਜਾਂਦਾ ਮਹੀਨਾ ਵੀ ਨਹੀਂ ਕੱਢਿਆ ਇਹ ਨੇ ਦੋ ਹਫ਼ਤੇ ਦੇ ਵਿੱਚ ਵਿੱਚ ਹੀ ਰੰਗ ਦਿਖਾ ਤੇ ਆਪਣੇ ਟੁੱਟਣ ਹੀ ਲੱਗ ਪਿਆ ਫਟਣ ਹੀ ਲੱਗ ਪਿਆ ਜੇ ਨਾਲੇ ਤੁਸੀਂ ਕਿਹਾ ਸੀ ਵਾਟਰ ਪਰੂਫ ਹੈ ਇਹ ਕਿੱਧਰ ਦਾ ਵਾਟਰ ਪਰੂਫ ਹੈ ਹੀ ਨਹੀਂ ਵਾਟਰ ਭਾਅ ਜੀ ਇਹ ਮੈਂ ਉਹੀ ਉਦੋਂ ਵਰਖਾ 'ਚ ਮੈਂ ਆਪਣਾ ਲੈਪਟੋਪ ਪਰਸ ਅਤੇ ਫੋਨ ਵਗੈਰਾ ਪਾਇ ਦਾ ਸੀ ਮੈਂ ਕਿਹਾ ਚੱਲ ਕਿਹੜਾ ਕੋਈ ਗਿੱਲਾ ਹੋਏਗਾ ਵਾਟਰ ਪਰੂਫ ਹੀ ਹੈ ਵਾਟਰ ਪਰੂਫ ਕਿੱਧਰ ਦਾ ਹੋ ਗਿਆ ਖ਼ਰਾਬ ਹੀ ਕਰਤਾ ਇਹਨੇ ਭਾਅ ਜੀ ਇਹ ਗਿੱਲਾ ਹੋ ਗਿਆ ਅੰਦਰ ਪਾਣੀ ਪਾਣੀ ਹੋ ਗਿਆ ਮੇਰਾ ਪਰਸ ਵੀ ਗਿੱਲਾ ਹੋ ਗਿਆ ਪੈਸੇ ਵੀ ਸਾਰੇ ਖ਼ਰਾਬ ਹੋ ਗਏ ਲੈਪਟੋਪ ਵੀ ਗ ਲੈਪਟੋਪ 'ਚ ਵੀ ਪਾਣੀ ਪਾਣੀ ਹੋ ਗਿਆ ਫੋਨ ਵੀ ਖ਼ਰਾਬ ਹੋ ਗਿਆ ਹੁਣੇ ਫੋਨ ਦੇ ਕੇ ਆਇਆ ਥੋੜ੍ਹੀ ਦੇਰ ਪਹਿਲਾਂ ਹਾਂਜੀ ਨਹੀਂ ਨਹੀਂ ਭਾਅ ਜੀ ਮੈਂ ਉਹ ਥੋੜ੍ਹਾ ਨਾ ਗੱਲ ਜਿਹੜਾ ਤੁਹਾਡੇ ਕੋਲੋਂ ਪਹਿਲਾਂ ਬੈਗ ਲਿਆ ਸੀ ਉਹ ਜ਼ਿਆਦਾ ਸਹੀ ਸੀ ਉਹ ਤਾਂ ਮਾੜਾ ਜਿਹਾ ਖ਼ਰਾਬ ਮਤਲਬ ਪੁਰਾਣਾ ਹੋ ਗਿਆ ਸੀ ਗੰਦਾ ਗੰਦਾ ਜਿਹਾ ਹੋ ਗਿਆ ਸੀ ਤਾਂ ਮੈਂ ਸੋਚਿਆ ਕਿ ਚੱਲ ਨਿਆ ਬੈਗ ਖਰੀਦ ਲੈਂਦੇ ਹਾਂ ਹਾਂਜੀ ਹਾਂਜੀ ਇਹੀ ਭਾਅ ਜੀ ਕੰਮ ਕਾਰ ਨੂੰ ਏ ਖਰੀਦਿਆ ਬੈਗ ਮੈਂ ਕਿਹਾ ਚੱਲ ਕੋਈ ਨਹੀਂ ਹਾਂਜੀ ਨਹੀਂ ਭਾਅ ਜੀ ਹੁਣ ਤਾਂ ਕੁਛ ਨਹੀਂ ਹੁਣ ਤੁਸੀਂ ਨਿਆ ਬੈਗ ਦਿਖਾਓ ਇੱਕ ਜਿਹੜਾ ਠੀਕ ਠਾਕ ਹੋਏ ਟਾਈਮ ਕੱਢਣ ਜੋਗਾ ਹੋਏ ਵਾਟਰ ਪਰੂਵ ਦਾ ਕੀ ਹੈ ਵਾਟਰ ਪਰੂਫ ਦਾ ਇਹ ਗੋਲੀ ਮਾਰੋ ਆਹ ਟਾਈਮ ਕੱਢਣ ਜੋਗਾ ਹੋ ਜਾਵੇ ਬਸ ਟਾਈਮ ਕੱਢ ਦੇ ਮੇਰਾ ਆਹੋ ਸਾਲ ਕੁ ਦੋ ਸਾਲ ਕੱਢ ਦੇ ਬਾਕੀ ਫਿਰ ਸਾਲ ਦੋ ਸਾਲ ਬਾਅਦ ਨਿਆ ਬੈਗ ਖਰੀਦ ਲਾਂਗੇ ਹਾਂਜੀ ਹਾਂਜੀ ਆਹ ਇਹ ਠੀਕ ਹੈ ਇਹ ਦੇ ਦਿਓ ਤੁਸੀਂ ਠੀਕ ਹੈ ਭਾਅ ਜੀ ਚਲੋ ਚੰਗਾ ਫਿਰ ਓਕੇ ਮਿਲਾਂਗੇ ਲਾਵਾਂਗੇ ਫਿਰ ਮੁੜ ਕੇ ਚੱਕਰ ਓਕੇ